ਪੰਜਾਬ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਇਹ ਪੰਜਾਬ ਇੱਕੋ ਹੀ ਹੈ ਪਰ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਚਾਰ ਜੌਨ ਹਨ ਜਿਹਨਾਂ ਨੂੰ ਵਿੱਚ ਅਸੀਂ ਚਾਰ ਜੌਨਾਂ ਦੇ ਵਿੱਚੋਂ ਅਸੀਂ ਇੱਕ ਮੇਨ ਦੁਆਬਾ ਜੌਨ ਹੈ ਇੱਕ ਮਾਝਾ ਜੌਨ ਹੈ ਇੱਕ ਮਾਲਵਾ ਜੌਨ ਹੈ ਇੱਕ ਪੁਆਧ ਜੌਨ ਆ ਪੰਜਾਬ ਨੂੰ ਚਾਰ ਜੌਨਾਂ ਵਿੱਚ ਵੰਡਿਆ ਗਿਆ ਹੈ ਅਤੇ ਇਹ ਜੋਨ ਅਲੱਗ ਅਲੱਗ ਜੌਨ ਹਨ ਪਰ ਇਹਨਾਂ ਦੇ ਵਿੱਚ ਜੌਨਾਂ ਦੇ ਵਿੱਚ ਜਿਹੜਾ ਦੁਆਬਾ ਜੌਨ ਹੈ ਉਹ ਸਤਲੁਜ ਅਤੇ ਬਿਆਸ ਦੇ ਦਰਮਿਆਨ ਹੈ ਜਿਹੜਾ ਮਾਲਵਾ ਜੌਨ ਹੈ ਉਹ ਸਤਲੁਜ ਤੋਂ ਅੱਗੇ ਦਾ ਜੌਨ ਹੈ ਅਤੇ ਜਿਹੜਾ ਮਾਝਾ ਜੌਨ ਹੈ ਉਹ ਸਤਲੁਜ ਤੋਂ ਪਿੱਛੇ ਬਿਆਸ ਇੱਧਰੋਂ ਟੱਪ ਕੇ ਰਈਆ ਅੰਮ੍ਰਿਤਸਰ ਗੁਰਦਾਸਪੁਰ ਸਾਈਡ ਉਹ ਮਾਲਵਾ ਹੈ ਮਾਝਾ ਜੌਨ ਹੈ ਅਤੇ ਪੁਆਧ ਜੌਨ ਜਿਹੜਾ ਹੈਗਾ ਇਹ ਰੂਪਨਗਰ ਸਾਈਡ 'ਤੇ ਉਹਨੂੰ ਪੁਆਧ ਜੌਨ ਹੈ ਇਹਨਾਂ ਦੇ ਵਿੱਚ ਅਲੱਗ ਅਲੱਗ ਭਾਸ਼ਾ ਹੁੰਦੀਆਂ ਹਨ ਇਸ ਕਰਕੇ ਅਸੀਂ ਉਹਨਾਂ ਨੂੰ ਚਾਰ ਜੌਨਾਂ ਵਿੱਚ ਵੰਡਿਆ ਗਿਆ ਹੈ ਅਤੇ ਅੱਜ ਕੱਲ੍ਹ ਤਾਂ ਇਹ ਜੌਨ ਸਾਰੇ ਪੰਜਾਬ ਵਿੱਚ ਬਰਾਬਰ ਹੀ ਸਮਝੇ ਜਾਂਦੇ ਹਨ ਕਿਉਂਕਿ ਇਹਨਾਂ ਦੇ ਵਿੱਚ ਇੱਥੋਂ ਮਾਝੇ ਮਾਲਵਾ ਦੁਆਬੇ ਦੇ ਵਿੱਚੋਂ ਲੋਕੀ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਵੱਸੇ ਹਨ ਅਤੇ ਉਹ ਹੁਣ ਬੋਲੀਆਂ ਦਾ ਵੀ ਇੰਨਾ ਕੋਈ ਫਰਕ ਨਹੀਂ ਹੈਗਾ ਪਹਿਲਾਂ ਇਹਨਾਂ ਦਾ ਬੋਲੀਆਂ ਦੇ ਵਿੱਚ ਫਰਕ ਹੁੰਦਾ ਸੀਗਾ ਪਰ ਹੁਣ ਬੋਲੀਆਂ ਦਾ ਫਰਕ ਬਹੁਤ ਘੱਟ ਗਿਆ ਹੈ ਇਸ ਕਰਕੇ ਇਹਨਾਂ ਨੂੰ ਆਪਾਂ ਹੁਣ ਚਾਰ ਜੌਨ ਵਿੱਚ ਪਹਿਲਾਂ ਵੰਡਿਆ ਗਿਆ ਸੀ ਪਰ ਹੁਣ ਸਾਰਾ ਪੰਜਾਬ ਇਕੱਠਾ ਤਕਰੀਬਨ ਇਕੱਠਾ ਹੀ ਹੈ ਪੰਜਾਬ ਨੂੰ ਆਪਾਂ ਵਧੀਆ ਹੈ ਪੰਜਾਬ ਸਾਡਾ ਬਾਕੀ ਬਾਕੀ ਜਗ੍ਹਾ ਨਾਲੋਂ ਪੰਜਾਬ ਬਹੁਤ ਵਧੀਆ ਪੰਜਾਬ ਹੈਗਾ ਆਪਾਂ ਇਹਨਾਂ ਨੂੰ ਸਾਰੇ ਪੰਜਾਬ ਨੂੰ ਏਕਾ ਹੈਗਾ ਸਾਰੇ ਪੰਜਾਬ ਵਿੱਚ ਇਕੱਠੀ ਹੁਣ ਬੋਲੀ ਬੋਲੀ ਜਾਂਦੀ ਹੈ ਪਰ ਕਈ ਜਗ੍ਹਾ 'ਤੇ ਕੁਛ ਪਿੱਛੜਿਆ ਇਲਾਕਾ ਹੈ ਉੱਥੇ ਇਹੋ ਪੁਰਾਣੀ ਬੋਲੀ ਹੀ ਬੋਲੀ ਜਾਂਦੀ ਹੈ ਇਸ ਕਰਕੇ ਅਸੀਂ ਪੰਜਾਬ ਨੂੰ ਬਹੁਤ ਹੀ ਵਧੀਆ ਸਾਡਾ ਮੁਲਕ ਹੈਗਾ